ਜੇ ਕੋਈ ਵੀ ਵਿਅਕਤੀ ਗਾਉਣਾ ਚਾਹੁੰਦਾ ਆ ਜਾਂ ਆਪਣੇ ਗਾਉਣ ਦੇ ਹੁਨਰ ਹੁਨਰ ਨੂੰ ਸੁਧਾਰਨਾ ਚਾਹੁੰਦਾ ਹੈ ਤਾਂ ਉਸ ਵਿਅਕਤੀ ਲਈ ਮੇਰੀ ਸਲਾਹ ਇਹ ਹੈ ਕਿ ਸਭ ਤੋਂ ਪਹਿਲਾਂ ਆਪਣੇ ਆਵਾਜ਼ ਨੂੰ ਸਮਝੋ ਹਰ ਕਿਸੇ ਦੀ ਆਵਾਜ਼ ਵੱਖਰੀ ਹੁੰਦੀ ਹੈ ਆਪਣੀ ਆਵਾਜ਼ ਦੀ ਰੇਂਜ ਕਿਸਮ ਅਤੇ ਵਿਸ਼ੇਸ਼ ਵਿਸ਼ੇਸ਼ਤਾਵਾਂ ਨੂੰ ਸਮਝਣ ਲਈ ਹਮੇਸ਼ਾ ਸਮਾਂ ਕੱਢਣਾ ਚਾਹੀਦਾ ਹੈ ਅਤੇ ਸਾਨੂੰ ਇਹ ਵੀ ਉਹਨਾਂ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਉਹਨਾਂ ਦੀ ਜਿਹੜੀ ਆਵਾਜ਼ ਆ ਕਿਹੜੇ ਗੀਤਾਂ ਵਿੱਚ ਸਭ ਤੋਂ ਵਧੀਆ ਆ ਜਿਵੇਂ ਕਿ ਸੈਡ ਸੌਂਗ ਦੇ ਵਿੱਚ ਜ਼ਿਆਦਾ ਵਧੀਆ ਆ ਜਾਂ ਦੂਸਰੇ ਸੌਂਗ ਦੇ ਵਿੱਚ ਜ਼ਿਆਦਾ ਵਧੀਆ ਆ ਅਤੇ ਦੂਸਰੇ ਨੰਬਰ 'ਤੇ ਉਹਨਾਂ ਨੂੰ ਸਿਖਲਾਈ ਲੈਣੀ ਚਾਹੀਦੀ ਆ ਅਤੇ ਉਹਨਾਂ ਨੂੰ ਕਿਸੇ ਤੋਂ ਟ੍ਰੇਨਿੰਗ ਲੈਣੀ ਚਾਹੀਦੀ ਹੈ ਜਿਹੜਾ ਕਿ ਇਸ ਚੀਜ਼ ਦੇ ਵਿੱਚ ਮਾਹਰ ਹੋਵੇ ਅਤੇ ਉਸ ਤੋਂ ਇਲਾਵਾ ਉਹਨਾਂ ਨੂੰ ਡੇਲੀ ਦਾ ਅਭਿਆਸ ਸ਼ੁਰੂ ਕਰਨਾ ਚਾਹੀਦਾ ਆ ਡੇਲੀ ਉਹਨਾਂ ਨੂੰ ਰਿਹਾਸਲ ਕਰਨੀ ਚਾਹੀਦੀ ਆ ਗਾਉਣ ਦੀ ਸਭ ਤੋਂ ਮੇਨ ਥਿੰਗ ਉਹਨਾਂ ਨੂੰ ਵੱਧ ਤੋਂ ਵੱਧ ਜਿਹੜੇ ਸੌਂਗ ਸੁਣਨੇ ਚਾਹੀਦੇ ਆ ਠੀਕ ਆ ਉਹਨਾਂ ਨੂੰ ਆਪਣੇ ਮਨਪਸੰਦ ਗਾਇਕਾਂ ਨੂੰ ਸੁਣਨਾ ਚਾਹੀਦਾ ਮਨਪਰਾ ਮਨਪਸੰਦ ਸੌਂਗ ਨੂੰ ਸੁਣਨਾ ਚਾਹੀਦਾ ਆ ਕਿਉਂਕਿ ਉਹਨਾਂ ਤੋਂ ਸੁਣ ਕੇ ਉਹ ਆਪਣੀ ਜਿਹੜੀ ਆਪਣੀ ਗਾਉਣ ਦੀ ਜਿਹੜੀ ਕੁਸ਼ਲਤਾ ਆ ਉਹਨੂੰ ਵਧਾ ਸਕਦੇ ਆ ਤੇ ਉਹ ਸਭ ਤੋਂ ਜਿਹੜੀ ਮੇਨ ਚੀਜ਼ ਆ ਉਹਨਾਂ ਵਿੱਚ ਕੌਨਫੀਡੈਂਸ ਹੋਣਾ ਚਾਹੀਦਾ ਆ ਠੀਕ ਆ ਉਹਨਾਂ ਨੂੰ ਜਨਤਾ ਦੇ ਸਾਹਮਣੇ ਬੋਲਣ ਦਾ ਗਾਉਣ ਦਾ ਕੋਨਫੀਡੈਂਸ ਹੋਣਾ ਚਾਹੀਦਾ ਆ ਅਤੇ ਮੇਰੇ ਖਿਆਲ ਦੇ ਨਾਲ ਕੋਨਫੀਡੈਂਸ ਜਿਹੜਾ ਉਹ ਸਭ ਤੋਂ ਵੱਡੀ ਚੀਜ਼ ਆ ਆਪਣੇ ਹੁਨਰ ਨੂੰ ਲੋਕਾਂ ਸਾਹਮਣੇ ਦਿਖਾਉਣ ਦੇ ਲਈ ਅਤੇ ਉਹਨਾਂ ਨੂੰ ਹਮੇਸ਼ਾ ਜਨਤਕ ਥਾਵਾਂ 'ਤੇ ਗਾਉਣਾ ਚਾਹੀਦਾ ਆ ਉਹਨਾਂ ਨੂੰ ਲੋਕਾਂ ਤੋਂ ਡਰਨਾ ਨਹੀਂ ਚਾਹੀਦਾ ਜੇ ਕੋਈ ਉਹਨਾਂ ਦਾ ਮਜ਼ਾਕ ਵੀ ਉਡਾਉਣਾ ਤਾਂ ਉਹਨਾਂ ਨੂੰ ਇਸ ਚੀਜ਼ ਵਿੱਚ ਚੀਜ਼ ਦੀ ਸਹਿਣਸ਼ੀਲਤਾ ਹੋਣੀ ਚਾਹੀਦੀ ਆ ਕਿਉਂਕਿ ਉਹ ਇਸੇ ਇ ਇੱਦਾਂ ਹੀ ਕਰਕੇ ਆਪਣੀ ਕੋਨਫੀਡੈਂਸ ਨੂੰ ਬਿਲਡਅੱਪ ਕਰ ਸਕਦੇ ਹਨ ਧੰਨਵਾਦ